ਪੰਜਾਬੀ ਭਾਸ਼ਾ ਤੁਹਾਡੇ ਰਾਜ ਦੀਆਂ ਖੇਤਰੀ ਉਪਭਾਸ਼ਾਵਾਂ ਤੋਂ ਕਿਵੇਂ ਵੱਖਰੀ ਆ ਉਹ ਇਦਾਂ ਵੱਖਰੀ ਆ ਵੀ ਵੈਸੇ ਤਾਂ ਸਾਰੀਆਂ ਭਾਸ਼ਾਵਾਂ ਆਪਣੀ ਆਪਣੀ ਜਗ੍ਹਾ ਕੰਮ ਕਰਦੀਆਂ ਨੇ ਸਾਰੀਆਂ ਨੂੰ ਸਾਰੀਆਂ ਸਾਰੇ ਲੋਕ ਆਪਣੀ ਆਪਣੀਆਂ ਭਾਸ਼ਾਵਾਂ ਬੋਲਦੇ ਹਨ ਪਰ ਪੰਜਾਬੀ ਇੱਦਾਂ ਵੱਖਰੀ ਆ ਵੀ ਇਹ ਇਹਦੀ ਪੰਜਾਬ 'ਚੋਂ ਵੱਖਰੀ ਉਹ ਮਤਲਬ ਵੀ ਕਹਿਣ ਦਾ ਭਾਵ ਮਿੱਟੀ 'ਚੋਂ ਵੀ ਪੰਜਾਬੀ ਦੀ ਖੁਸ਼ਬੂ ਆਉਂਦੀ ਆ ਮਾਂ ਭਾਸ਼ਾਵਾਂ ਲੱਗਦੀ ਆਂ ਅਤੇ ਪੰਜਾਬੀ ਇੱਕ ਮਿੱਠੀ ਸੁਰੀਲੀ ਮਤਲਬ ਮਿੱਟੀ ਨਾਲ ਜੁੜੀ ਹੋਈ ਇਹੋ ਜਿਹੀ ਭਾਸ਼ਾਵਾਂ ਵੀ ਇਹਨੂੰ ਬੰਦਾ ਬਿਨਾਂ ਪੜ੍ਹੇ ਲਿਖੇ ਤੋਂ ਵੀ ਐਨ ਪਿਓਰ ਬੋਲ ਸਕਦਾ

ਪਿਓਰ ਬੋਲ ਸਕਦਾ ਅਤੇ ਆਪਾਂ ਜਿੰਨ ਮਤਲਬ ਕਿ ਪ ਪੰਜਾਬ 'ਚ ਜੋ ਵੀ ਪੰਜਾਬੀ ਆ ਜਾਂ ਹੋਰ ਆ ਭਾਵੇਂ ਆਪਣੇ ਉਹ 'ਚ ਮਨੋਰੰਜਨ ਲਈ ਕਿੰਨੇ ਤਰ੍ਹਾਂ ਦੇ ਗਾਣੇ ਇੰਗਲਿਸ਼ ਹਿੰਦੀ ਵਿੱਚ ਕਿੰਨੀਆਂ ਭਾਸ਼ਾਵਾਂ ਦੇ ਆਉਦੇ ਹਾਂ ਪਰ ਪੰਜਾਬੀ ਭਾਸ਼ਾ ਸੁਣੇ ਬਿਨਾਂ ਸਵਾਦ ਜਿਹਾ ਨਹੀਂ ਆਉਂਦਾ ਅੱਜ ਕੱਲ੍ਹ ਤਾਂ ਪੰਜਾਬੀ ਭਾਸ਼ਾ ਬਹੁਤ ਪ੍ਰਚੱਲਤ ਹੋ ਰਹੀ ਆ ਵੀ ਬੋਂਬੇ ਤੱਕ ਜਾਂ ਇੰਡੀਆ 'ਚ ਸਾਰੇ ਇੰਡੀਆ ਤੋਂ ਬਾਹਰ ਵੀ ਆਪਣੇ ਪੰਜਾਬੀ ਜਾ ਜਾ ਕੇ ਇਹਨਾਂ ਨੂੰ ਆਪਣੀ ਮਾਤ ਭਾਸ਼ਾ ਭਾਸ਼ਾ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰ ਕਰ ਰਹੇ ਨੇ ਅਤੇ ਵੱਖ ਵੱਖ ਕੈਨੇਡਾ ਅਮੈਰੀਕਾ 'ਚ ਵੀ ਹੁਣ ਆਉਣ ਵਾਲੇ ਸਮੇਂ 'ਚ ਪੰਜਾਬੀ ਓ ਤਕਰੀਬਨ ਬੈਠੇ ਹਾਂ ਅਤੇ ਉੱਥੇ ਵੀ ਪੰਜਾਬੀ ਬੋਲਣ ਲਈ ਗੋਰੇ ਵੀ ਬੋਲਣ ਲੱਗ ਜਾਣਗੇ ਹੌਲੀ ਹੌਲੀ